ਸਾਡੇ ਸ਼ਹਿਰ ਵਿੱਚ ਲੋਕਾਂ ਦਾ ਮਨਪਸੰਦ ਰੈਸਟੋਰੈਂਟ ਬਰਗਰ ਹੱਟ ਹੈ ਅਸੀਂ ਇਸ ਰੈਸਟੋਰੈਂਟ ਨਾਲ ਕਾਫੀ ਸਮੇਂ ਤੋਂ ਜੁੜੇ ਹਾਂ ਕੁਝ ਕੁ ਮਹੀਨਿਆਂ ਤੋਂ ਇਸ ਦੇ ਸਟਾਫ ਵਿੱਚ ਤਬਦੀਲੀ ਆਉਣ ਕਰਕੇ ਕਾਫੀ ਕੁਝ ਬਦਲਿਆ ਨਜ਼ਰ ਆ ਰਿਹਾ ਹੈ ਜਿਸ ਕਾਰਨ ਮੈਂ ਕੁਝ ਹਦਾਇਤਾਂ ਦੇਣੀਆਂ ਚਾਹੁੰਦੀ ਹਾਂ ਪਰ ਮੈਨੂੰ ਯਕੀਨ ਹੈ ਕਿ ਤੁਸੀਂ ਮੇਰੀਆਂ ਉਹਨਾਂ ਹਦਾਇਤਾਂ ਨੂੰ ਜੁਬਾਨੀ ਯਾਦ ਨਹੀਂ ਰੱਖ ਪਾਉਗੇ ਸੋ ਇਸ ਕਰਕੇ ਜਿਵੇਂ ਕਿ ਅੱਜ ਕੱਲ ਮੋਬਾਈਲ ਇੰਟਰਨੈਟ ਦਾ ਯੁੱਗ ਹੈ ਅਤੇ ਮੈਂ ਚਾਹੁੰਦੀ ਹਾਂ ਕਿ ਤੁਹਾਡੇ ਰੈਸਟੋਰੈਂਟ ਦੀ ਵੈਬਸਾਈਟ ਦੇ ਵਿੱਚ ਰਿਕਾਰਡ ਰਹਿਣ ਜਾਂ ਜਦੋਂ ਤੁਸੀਂ ਮੇਰੀਆਂ ਇਹਨਾਂ ਹਦਾਇਤਾਂ ਨੂੰ ਰਿਪੀਟ ਸੁਣ ਸਕੋ ਅਤੇ ਰੈਸਟੋਰੈਂਟ ਦੀ ਸੈਟਿੰਗ ਦੇ ਵਿੱਚ ਹੋਰ ਤਬਦੀਲੀਆਂ ਅਤੇ ਹੋਰ ਵਾਧਾ ਲਿਆ ਸਕੋ ਇਹਨਾਂ ਵਿੱਚੋਂ ਕੁਝ ਕੁ ਹਦਾਇਤਾਂ ਇਸ ਪ੍ਰਕਾਰ ਹਨ ਜਿਵੇਂ ਕਿ ਵੈਜ ਅਤੇ ਨੋਨ ਵੈਜ ਵੱਖਰੇ ਵੱਖਰੇ ਸਰਵ ਕੀਤੀਆਂ ਜਾਣ ਸਰਵਿੰਗ ਟੇਬਲ ਹਰ ਵਾਰ ਸਾਫ ਕੀਤੇ ਜਾਣ ਗ੍ਰਾਹਕਾਂ ਨੂੰ ਪੀਣ ਵਾਸਤੇ ਫਿਲਟਰ ਜਾਂ ਮਿਨਰਲ ਵੋ ਪਾਣੀ ਦਿੱਤਾ ਜਾਵੇ ਕੋਈ ਵੀ ਹਾਨੀ ਕ ਦਾਰ ਪਦਾਰਥ ਦੀ ਮਿਲਾਵਟ ਨਾ ਹੋਵੇ ਗ੍ਰਾਹਕਾਂ ਦੀ ਸਿਹਤ ਨੂੰ ਮੱਦੇਨਜ਼ਰ ਰੱਖਿਆ ਜਾਵੇ ਬੱਚਿਆਂ ਦੇ ਲਈ ਖਾਣ ਦੀਆਂ ਕਿਸਮਾਂ ਵਿੱਚ ਦੋ ਚਾਰ ਹੋਰ ਵਰੈਟੀਆਂ ਉਪਲਬਧ ਕਰਵਾਈਆਂ ਜਾਣ ਅਤੇ ਵੀਕਐਂਡ ਦੇ ਵਿੱਚ ਇਸ ਦਾ ਸਮਾਂ ਅਤੇ ਸਟਾਫ ਵਧਾਇਆ ਜਾਵੇ ਜਾਂ ਤੋ ਤਾਂ ਜੋ ਹਰੇਕ ਗ੍ਰਾਹਕ ਦਾ ਸਮਾਂ ਵੀ ਬਚਾਇਆ ਜਾ ਸਕੇ